ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਨੂੰ ਪਹਿਲਾਂ ਆਪਣਾ ਉਹ ਕੰਪਿਊਟਰ ਦਾ ਮਾਡਲ ਦੱਸ ਦਿਓ ਅਤੇ ਮੈਨੂਫੈਕਚਰਿੰਗ ਵੀ ਦੱਸ ਦਿਓ ਇੱਕ ਵਾਰੀ ਕਦੋਂ ਦੀ ਹੋਈ ਸੀ ਆਈ ਥਰੀ ਠੀਕ ਹੈ ਜੀ

ਅੱਛਾ ਜੀ ਅਤੇ ਉਹ ਆਪਣਾ ਬਰੈਂਡ ਕਿਹੜਾ ਹੈ ਅੱਛਾ ਜੀ ਅਤੇ ਪ੍ਰੋਬਲਮ ਕੀ ਆ ਰਹੀ ਹੈ ਹੁਣ ਤੁਹਾਨੂੰ

ਅੱਛਾ ਜੀ ਅੱਛਾ ਅਤੇ ਇਹਦੀ ਤਾਂ ਇਹੀ ਆ ਵੀ ਪ੍ਰੋਬਲਮ ਏ ਹੈ ਵੀ ਤੁਹਾਡਾ ਇੱਕ ਤਾਂ ਰੈਮ ਘੱਟ ਹੋਏਗੀ ਰੈਂਡਮ ਐਕਸੈਸ ਮੈਮਰੀ ਜਿਹਨੂੰ ਆਪਾਂ ਕਹਿੰਦੇ ਹਾਂ ਅਤੇ ਇੱਕ ਜਿਹੜਾ ਤੁਸੀਂ ਕਹਿਨੇ ਹੋ ਕਿ ਫਸਟ ਸਕਰੀਨ 'ਤੇ ਚਲਾ ਜਾਂਦਾ ਉਹ ਸਕਰੀਨ ਰੈਫਰੇਸ਼ ਰੇਟ ਤੁਹਾਡਾ ਮੈਚ ਨਹੀਂ ਕਰਦਾ ਹੋਏਗਾ ਸੋਲਿਡ ਬਕਸ ਦੇ ਨਾਲ਼ ਅਤੇ ਇੱਕ ਪ੍ਰੋਬਲਮ ਹੋਰ ਹੋ ਸਕਦੀ ਹੈ ਬਈ ਤੁਹਾਡਾ ਜਿਹੜਾ ਗ੍ਰੈਫਿਕ ਕਾਰਡ ਨਹੀਂ ਹੋਵੇਗਾ ਉਹਦੇ 'ਚ ਗਰੈਫ ਓਹੀ ਹੈ ਨਾ ਫ਼ੇਰ ਆਪਾਂ ਨੂੰ ਸੋਲਿਡ ਵਰਕ ਲਈ ਗ੍ਰੈਫਿਕ ਕਾਰਡ ਜ਼ਰੂਰੀ ਹੁੰਦਾ ਦੇਖੋ ਜੇ ਤੁਸੀਂ ਆਪਣਾ ਪ੍ਰੋਸੈਸਰ ਅਪਡੇਟ ਕਰਾ ਸਕਦੇ ਓਂ ਆਈ ਥਰੀ ਤੋਂ ਤੁਹਾਡੇ ਕੋਲ਼ ਲੈਪਟੋਪ ਹੈ ਨਾ ਪੀ ਸੀ ਹੈ ਤਾਂ ਤੁਸੀਂ ਆਈ ਫਾਈਵ ਆਪਣਾ ਸੀ ਪੀ ਯੂ 'ਚ ਇੰਸਟੋਲ ਕਰਵਾ ਲਓ ਅਤੇ ਨਾਲ਼ ਗ੍ਰੈਫਿਕ ਕਾਰਡ ਕਰਵਾ ਲਿਓ ਬੱਤੀ ਜੀ ਬੀ ਦਾ ਨਬੀੜਿਆ ਦਾ

ਨਹੀਂ ਨਹੀਂ ਹੋ ਜੇਗਾ ਇੰਸਟਾਲ ਹੋ ਜੂਗਾ ਗ੍ਰੈਫਿਕ ਕਾਰਡ ਮਿਨੀਮਮ ਆ ਜਾਂਦਾ ਪੰਜ ਹਜ਼ਾਰ ਤੋਂ ਲੈ ਕੇ ਤੀਹ ਹਜ਼ਾਰ ਤੱਕ ਦੇ ਆਉਂਦੇ ਹੈ ਅਤੇ ਅਤੇ ਪ੍ਰੋਸੈਸਰ ਆਪਣਾ ਆਈ ਫਾਈਵ ਦਾ ਮੈਕਸੀਮਮ ਜੇ ਵਧੀਆ ਜਨਰੇਸ਼ਨ ਦਾ ਲੈਣਾ ਤੁਸੀਂ ਜਨਰੇਸ਼ਨ ਟਵੈਲਵ ਦਾ ਤਾਂ ਅਪਰੋਕਸੀਮੇਟਲੀ ਗਿਆਰ੍ਹਾਂ ਕ ਦੇ ਨੇੜੇ ਤੇੜੇ ਆ ਜੇਗਾ ਹਾਂਜੀ ਹਾਂਜੀ ਇਲੈਵਨ ਥਾਊਜੈਂਟ ਪੂਰ ਪੂਰਾ ਸੀ ਪੀ ਯੂ ਪੂਰਾ ਸੀ ਪੀ ਯੂ ਜੇ ਤੁਸੀਂ ਵਧੀਆ ਤਰੀਕੇ ਨਾਲ਼ ਸੋਲਿਡ ਬਗ ਵਗੈਰਾ ਚਲਾਉਣਾ ਤਾਂ ਪੰਜਾਹ ਸੱਠ ਹਜ਼ਾਰ ਪੰਜਾਹ ਕ ਹਜ਼ਾਰ ਦੇ ਨੇੜੇ ਤੇੜੇ ਲੱਗ ਜੇਗਾ ਤਾਡਾ ਸਕਰੀਨ ਸਕਰੀਨ ਦੇਖੋ ਤੁਹਾਡਾ ਸਕਰੀਨ ਰਿਫਰੇਸ਼ ਰੇਟ 'ਤੇ ਡਿਪੈਂਡ ਕਰਦਾ ਅਤੇ ਹਾਂ ਜੇ ਗ੍ਰੈਫਿਕ ਕਾਰਡ ਨੂੰ ਕੋਈ ਕਰੇਗਾ ਤਾਂ ਵੀ ਇਹ ਫਰਕ ਪੈਂਦਾ ਦੋ ਤਰੀਕੇ ਨਾਲ਼ ਹੁੰਦਾ ਇੱਕ ਰਿਫਰੇਸ਼ ਰੇਟ ਅਤੇ ਗ੍ਰੈਫਿਕ ਕਾਰਡ ਦੋਨਾਂ 'ਤੇ ਸਕਰੀਨ ਦਾ ਈਫੈਕਟ ਪੈਂਦਾ

ਨਹੀਂ ਨਹੀਂ ਜੇ ਤੁਹਾਡਾ ਰੈਂਡਮ ਐਕਸੈਸ ਮੈਮਰੀ ਸਭ ਤੋਂ ਜ਼ਿਆਦੇ ਹੈ ਤਾਂ ਮਤਲਬ ਬੱਤੀ ਜੀ ਬੀ ਜਾਂ ਚੌਂਹਟ ਜੀ ਬੀ ਹੈ ਫ਼ੇਰ ਤਾਂ ਨਹੀਂ ਕੋਈ ਇਸ਼ੂ ਆਊਗਾ ਹੋ ਜਾਣਗੀਆਂ ਹੋ ਜਾਣਗੀਆਂ ਜੇ ਆਈ ਫਾਈਵ ਹੈਗਾ ਨਾ ਆਪਣਾ ਉਹ ਬਹੁਤ ਪੋਟੈਨਸ਼ੀਅਲ ਹੁੰਦਾ ਉਹਦੇ 'ਚ ਆਈ ਫਾਈਵ ਹੁੰਦਾ ਨਾ ਜਿਹੜਾ ਸੀ ਪੀ ਯੂ ਦਾ ਅਤੇ ਉਹਦੇ 'ਚ ਬਹੁਤ ਪੋਟੈਨਸ਼ੀਅਲ ਹੁੰਦਾ ਅਤੇ ਉਹ ਸਾਰਾ ਕੁਛ ਸਪੋਟ ਕਰ ਦੂੰਗਾ ਕੋਈ ਚੱਕਰ ਨਹੀਂ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਤੁਹਾਨੂੰ

ਠੀਕ ਹੈ ਜੀ ਠੀਕ